ਸੈਲਫ ਹੈਲਪ ਗਰੁੱਪ ਇੱਕ ਬਹੁਤ ਵਧੀਆ ਯੋਜਨਾ ਹੈ ਜੋ ਕਿ ਆਪਣੇ ਬੰਦੇ ਨੂੰ ਆਪਣੇ ਬਲ 'ਤੇ ਖੜ੍ਹੇ ਹੋਣ ਦੀ ਹਿੰਮਤ ਦਿੰਦਾ ਹੈ ਔਰਤਾਂ ਲਈ ਰੁਜ਼ਗਾਰ ਇੱਕ ਬਹੁਤ ਹੀ ਜ਼ਰੂਰੀ ਗੱਲ ਹੈ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਮਿਲਣੇ ਚਾਹੀਦੇ ਹਨ ਅਤੇ ਵਧੀਆ ਤੋਂ ਵਧੀਆ ਮਿਲਣੇ ਚਾਹੀਦੇ ਹਨ ਉਹਨਾਂ ਨੂੰ ਸਹੂਲਤਾਂ ਵੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਕਿ ਉਹਨਾਂ ਦੇ ਰੁਜ਼ਗਾਰ ਪ੍ਰਤੀ ਉਹਨਾਂ ਦੀ ਰੁਚੀ ਹੋਰ ਵੱਧਦੀ ਜਾਵੇ ਉਹਨਾਂ ਨੂੰ ਮੌਕੇ 'ਤੇ ਮੌਕਾ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਕਰ ਆਪਣੇ ਲਈ ਕੁਛ ਕਰ ਪਾਉਣ ਅਤੇ ਸਮਾਜ ਨੂੰ ਵੀ ਵਿਖਾ ਪਾਉਣ ਕਿ ਉਹ ਕੀ ਕੁਝ ਕਰ ਸਕਦੇ ਹਨ ਸੈਲਫ ਹੈਲਪ ਗਰੁੱਪ ਔਰਤਾਂ ਨੂੰ ਵੀ ਬੜਾ ਮਦਦ ਕਰਦਾ ਹੈ ਉਹਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਵਾਉਣ ਵਿੱਚ ਅਤੇ ਉਹਨਾਂ ਨੂੰ ਕਿੰਨੇ ਸਾਰੇ ਮੌਕੇ ਦਿੰਦਾ ਹੈ ਕਿ ਉਹ ਔਰਤਾਂ ਨੂੰ ਉਹਨਾਂ ਨੂੰ ਸ਼ਮਤਾ ਦੇ ਅਨੁਸਾਰ ਉਹਨਾਂ ਦੀ ਮਦਦ ਕਰ ਸਕਣ ਸੈਲਫ ਹੈਲਪ ਗਰੁੱਪ ਇੱਕ ਬੜਾ ਵਧੀਆ ਕੰਮ ਕਰਦਾ ਪਿਆ ਹੈ ਉਹ ਲੋਕਾਂ ਨੂੰ ਇਹ ਸਿਖਾਉਂਦਾ ਪਿਆ ਹੈ ਕਿ ਆਪਣੇ ਬਲ ਉੱਤੇ ਕੰਮ ਕਰਨਾ ਬਹੁਤ ਜ਼ਰੂਰੀ ਹੈ ਅਤੇ ਅੱਜ ਕੱਲ੍ਹ ਸਮਾਜ ਦੀ ਇਹੀ ਲੋੜ ਹੈ ਕਿ ਆਪਣੇ ਆਪ ਖੜ੍ਹੇ ਹੋਣ ਕਿਉਂਕਿ ਕੋਈ ਵੀ ਕਿਸੇ ਦੀ ਮਦਦ ਕਰਕੇ ਇਸ ਜ਼ਮਾਨੇ ਵਿੱਚ ਰਾਜ਼ੀ ਨਹੀਂ ਹੁੰਦਾ ਔਰਤਾਂ ਲਈ ਵੀ ਰੁਜ਼ਗਾਰ ਦੇ ਮੌਕੇ ਹੋਣੇ ਚਾਹੀਦੇ ਹਨ ਅਤੇ ਵਧੀਆ ਤੋਂ ਵਧੀਆ ਹੋਣੇ ਚਾਹੀਦੇ ਹਨ ਧੰਨਵਾਦ